ਹੈਲੋ ਹਾਂਜੀ ਇਹ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਾਲ ਕੀਤੀ ਸੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬੋਲਦੇ ਹੋ ਮੈਂ ਇਨਕੁਆਇਰੀ 'ਤੇ ਕਾਲ ਕੀਤੀ ਸੀ ਇਨਕੁਆਇਰੀ ਬੁਕਿੰਗ ਕਲਰਕ ਅੱਛਾ ਅੱਛਾ ਅੱਛਾ ਮੈਂ ਨਾ ਅਤੇ ਟਰੈਵਲਿੰਗ ਬਾਰੇ ਕੁਛ ਪੁੱਛਣਾ ਸੀ ਅਸੀਂ ਆਪਣੇ ਦਸ ਤਾਰੀਖ ਨੂੰ ਨਾ ਅਸੀਂ ਜਾਣਾ ਅੰਮ੍ਰਿਤਸਰ ਤੋਂ ਦਿੱਲੀ ਵਿਦ ਫੈਮਲੀ ਉਹਦੇ ਵਾਸਤੇ ਥੋੜ੍ਹੀ ਇਨਕੁਆਇਰੀ ਕਰਨੀ ਸੀ ਵੀ ਉਹ ਕਿਹੜੀ ਕਿਹੜੀ ਟ੍ਰੇਨ ਹੈ ਅੰਮ੍ਰਿਤਸਰ ਤੋਂ ਦਿੱਲੀ ਟ੍ਰੇਨ ਕਿੰਨੇ ਕਿੰਨੇ ਵਜੇ ਚੱਲਦੀ ਹੈ ਹਾਂਜੀ ਚੈੱਕ ਕਰਕੇ ਦੱਸੋ ਜਰਾ ਚੈੱਕ ਕਰਕੇ ਦੱਸੋ ਜਰਾ ਹਾਂਜੀ ਛੇ ਵਜੇ ਅੱਛਾ ਠੀਕ ਹੈ ਸ਼ਾਮ ਨੂੰ ਅੱਛਾ ਇਹ ਸਾਰੀਆਂ ਸੁਪਰਫਾਸਟ ਨੇ ਦੋਨੋਂ ਉਹ ਤਾਂ ਸੁਪਰਫਾਸਟ ਹੀ ਹੈ ਖੈਰ ਅੱਛਾ ਇਹਦੇ ਲਈ ਇੱਕ ਦੋ ਅਡਲਟ ਮੈਂ ਔਰ ਮੇਰੀ ਮਿਸਿਜ਼ ਔਰ ਦੋ ਬੱਚੇ ਚਾਰ ਜਣਿਆ ਵਾਸਤੇ ਤੁਸੀਂ ਚਾਰ ਸੀਟਾਂ ਸਾਨੂੰ ਚਾਹੀਦੀਆਂ ਨੇ ਸੈਕਿੰਡ ਏ ਸੀ ਦੀਆਂ ਇੱਕ ਤਾਂ ਅਵੇਲੇਬਿਲਟੀ ਸਾਨੂੰ ਤੁਸੀਂ ਦੱਸਣੀ ਹੈ ਕਿ ਅਵੇਲੇਬਲ ਸੀਟਾਂ ਹੈ ਕਿ ਨਹੀਂ ਦਸ ਤਾਰੀਖ ਦੀਆਂ ਦੂਸਰਾ ਜਿਹੜੀ ਵਿੱਚ ਜਿਹ 'ਚ ਸਾਨੂੰ ਕਨਫਰਮ ਮਿਲ ਜਾਵੇ ਸੋ ਤੁਸੀਂ ਰਾਤ ਦੇ ਕਿੰਨੇ ਵਜੇ ਦਸ ਪੰਜਾਹ 'ਤੇ ਅਤੇ ਸਾਨੂੰ ਐਕਚੁਅਲੀ ਕਨਫਰਮ ਸੀਟਾਂ ਚਾਹੀਦੀਆਂ ਨੇ ਕਨਫਰਮ ਵੇਟਿੰਗ ਨਹੀਂ ਚਾਹੀਦੀ ਆਰ ਐਸ ਸੀ ਨਹੀਂ ਚਾਹੀਦੀ ਅਤੇ ਤੁਸੀਂ ਅਗਰ ਆਪਣਾ ਆਪਣਾ ਸਿਸਟਮ ਦੋ ਅਡਲਟ ਦੋ ਚਿਲਡਰਨ ਤੁਸੀਂ ਆਪਣਾ ਸਿਸਟਮ ਚੈੱਕ ਕਰਕੇ ਮੈਨੂੰ ਇਹ ਦੱਸਣਾ ਵੀ ਸੀਟਾਂ ਕ ਇਹਨਾ ਤਿੰਨਾਂ ਚਾਰਾਂ ਟਰੇਨਾਂ 'ਚੋਂ ਕਿਹੜੀ ਟਰੇਨ 'ਚ ਕੰਨਫਰਮ ਨੇ ਅਤੇ ਇੱਕ ਚੀਜ਼ ਹੋਰ ਮੈਂ ਪੁੱਛਣੀ ਸੀ ਇਹ ਫੈਸਿਲਿਟੀਜ ਵਗੈਰਾ ਕੀ ਕੀ ਨੇ ਜਿਵੇਂ ਮੈਂ ਹੁਣ ਏ ਸੀ ਦੇ ਵਿੱਚ ਸਫ਼ਰ ਕਰਨਾ ਤਾਂ ਅੰਦਰ ਬੈਡਿੰਗ ਵਗੈਰਾ ਮਿਲਦਾ ਫੁਲ ਬੈਡਿੰਗ ਫੁਲ ਬੈਡਿੰਗ ਹੈ ਹੋਰ ਅਤੇ ਮਤਲਬ ਕੀ ਫਸਿਲਟੀ ਆ ਐਂਟਰੀ ਕਾਰ ਮਤਲਬ ਡਿਨਰ ਲੰਚ ਸਭ ਅੰਦਰ ਅਵੇਲੇਵਲ ਹੋਵੇ ਪਰ ਆਰਡਰ 'ਤੇ ਅੱਛਾ ਅੱਛਾ ਅੱਛਾ ਅੱਛਾ ਅਤੇ ਜਿੰਨਾ ਹਾਂ ਦੋ ਅਡਲਟ ਦੋ ਚਿਲਡਰਨ ਦਾ ਜਰਾ ਸਿਸਟਮ ਵਿੱਚ ਚੈੱਕ ਕਰਕੇ ਦੱਸੋ ਕਿਹੜੀ ਟਰੇਨ 'ਚ ਅਵੇਲੇਬਲ ਹੈਗੀਆਂ ਨੇ ਸੀਟਾਂ ਮੈਂ ਹੋਲਡ ਕਰ ਲੈਂਦਾ ਦਸ ਤਾਰੀਖ ਦੀਆਂ ਇਸ ਮੰਨਥ ਹਾਂਜੀ

ਉਹ ਹੀ ਆ ਬੰਦੇ ਭਾਰਤ ਅੱਛਾ ਠੀਕ ਹੈ ਸੈਕਿੰਡ ਏ ਸੀ ਅਵੇਲੇਵਲ ਨੇ ਨਹੀਂ ਰਾਤ ਵਾਲੀ 'ਚ ਵਿੱਚ ਕਰ ਦਓ ਤੁਸੀਂ ਬੰਦੇ ਭਾਰਤ 'ਚ ਚਾਰ ਸੀਟਾਂ ਬੁੱਕ ਕਰ ਦਓ ਅਤੇ ਇਹ ਦੱਸਣਾ ਮੈਨੂੰ ਕਿ ਸਾਰੀ ਫੈਸਿਲਿਟੀ ਵਗੈਰਾ ਸਭ ਅੱਛੀ ਹੈ ਬੰਦੇ 'ਚ ਮਤਲਬ ਖਾਣਾ ਵਗੈਰਾ ਅੱਛਾ ਹੁੰਦਾ ਅੱਛਾ ਅੱਛਾ ਅੱਛਾ ਅੱਛਾ ਓਕੇ ਓਕੇ ਓਕੇ ਹਰ ਚੀਜ਼ ਅਵੇਲੇਬਲ ਹੈ ਅਤੇ ਬੰਦੇ ਭਾਰਤ 'ਚ ਸੁਣਿਆ ਮੈਂ ਸਕਿਉਰਟੀ ਗਾਰਡ ਵਗੈਰਾ ਵੀ ਪੁਲਿਸ ਸ ਸਕਿਓਰਟੀ ਗਾਰਡ ਵੀ ਨਾਲ ਚੱਲਦੀ ਹੈ ਠੀਕ ਹੈ ਠੀਕ ਹੈ ਅਤੇ ਮੈਂ ਤੁਹਾਨੂੰ ਦੁਬਾਰਾ ਕਾਲ ਕਰਨਾ ਉਹਦੇ 'ਚ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਾਂਗਾ ਆਪਣੇ ਸੀਟਾਂ ਦੀ ਔਰ ਆਪਣੇ ਨਾਮ ਔਰ ਏਜ ਵਗੈਰਾ ਅਤੇ ਆਪਣਾ ਆਈ ਡੀ ਵਗੈਰਾ ਅਤੇ ਤੁਸੀਂ ਮੇਰੀਆਂ ਚਾਰ ਸੀਟਾਂ ਬੁੱਕ ਕਰਨੀਆਂ ਨੇ ਅਤੇ ਬਾਕੀ ਹਾਂਜੀ ਬੰਦੇ ਬੰ ਬੰ ਬੰਦੇ ਭਾਰਤ ਬੰਦੇ ਭਾਰਤ ਠੀਕ ਹੈ ਜੀ ਥੈਂਕ ਯੂ ਜੀ ਨੋਟ ਕਰ ਲੈਣਾ ਠੀਕ ਹੈ ਸਰ